ਮੈਂ ਕੁਕਿੰਗ ਕਰਨ ਦੇ ਲਈ ਕਦੇ ਵੀ ਕੋਈ ਕਲਾਸ ਜਾਂ ਫਿਰ ਵਰਕਸ਼ੋਪ ਹੈ ਜਿਹੜੀ ਉਹ ਨਹੀਂ ਲਗਾਈ ਹੈ ਜਿੰਨੇ ਵੀ ਕੁਕਿੰਗ ਕਰਨ ਦੇ ਗੁਣ ਜਾਂ ਫਿਰ ਕੁਕਿੰਗ ਕਲਾ ਕਰਨ ਦੀ ਕਲਾ ਹੈ ਜਿਹੜੀ ਉਹ ਮੈਂ ਮੁੱਢ ਤੋਂ ਹੀ ਆਪਣੇ ਮਾਤਾ ਜੀ ਤੋਂ ਹੀ ਸਿੱਖੀ ਹੈ ਸੋ ਕਦੇ ਵੀ ਕੋਈ ਵਰਕਸ਼ਾਪ ਜਾਂ ਫਿਰ ਕਲਾਸਾਂ ਨਹੀਂ ਲਗਾਈਆਂ ਅਤੇ ਨਾ ਹੀ ਮੈਨੂੰ ਵਰਕਸ਼ਾਪ ਜਾਂ ਫਿਰ ਕਲਾਸ ਲਗਾਉਣ ਦਾ ਕਦੇ ਮੌਕਾ ਹੀ ਮਿਲਿਆ ਹੈ ਪਰ ਜੇ ਮੈਨੂੰ ਕੁਛ ਵੀ ਇੱਦਾਂ ਦੀ ਵਰਕਸ਼ੋਪ ਜਾਂ ਫਿਰ ਕੁਕਿੰਗ ਕਲਾਸ ਲਗਾਉਣ ਦਾ ਮੌਕਾ ਜੇ ਮਿਲਦਾ ਹੈ ਤਾਂ ਮੈਂ ਚਾਹਵਾਂਗੀ ਕਿ ਜੋ ਵੀ ਅੱਜ ਕੱਲ੍ਹ ਸਾਨੂੰ ਬਾਹਰ ਫਾਸਟ ਫੂਡ ਖਾਣ ਨੂੰ ਮਿਲਦਾ ਹੈ ਉਸ ਫਾਸਟ ਫੂਡ ਵਾਲਾ ਸਵਾਦ ਹੀ ਆਪਾਂ ਸਿਹਤਮੰਦ ਚੀਜ਼ਾਂ ਬਣਾ ਕੇ ਕਿਵੇਂ ਲਿਆ ਕੇ ਲੈ ਕੇ ਆ ਸਕਦੇ ਹਾਂ ਉੱਦਾਂ ਦਾ ਕੁਛ ਮੈਂ ਖਾਣਾ ਹੈ ਜਿਹੜਾ ਉਹ ਸਿੱਖਣਾ ਚਾਵਾਂਗੀ ਜਿਹਦੇ ਨਾਲ ਅਸੀਂ ਬਾਹਰ ਸਟ੍ਰੀਟ ਫੂਡ ਹੈ ਜਿਹੜਾ ਜਾਂ ਫਾਸਟ ਫੂਡ ਆ ਉਹਦਾ ਸਵਾਦ ਵੀ ਲੈ ਸਕੀਏ ਤੇ ਅਸੀਂ ਆਪਣੀਆਂ ਸਿਹਤਾਂ ਵੀ ਨਾ ਖਰਾਬ ਕਰੀਏ ਇੱਦਾਂ ਦੇ ਖਾਣੇ ਸਿੱਖਣਾ ਚਾਹਵਾਂਗੀ ਜਿਹਦੇ ਵਿੱਚ ਜ਼ਿਆਦਾ ਕੋਈ ਪ੍ਰਜਰਵੇਟਿਵ ਨਾ ਪੈਂਦਾ ਹੋਵੇ ਜਾਂ ਫਿਰ ਕੋਈ ਵੀ ਪੈਕਿੰਗ ਵਾਲੀਆਂ ਚੀਜ਼ਾਂ ਜਿਹਦੇ ਵਿੱਚ ਨਾ ਵਰਤੀਆਂ ਜਾ ਸਕਦੀਆਂ ਹੋਣ ਅਤੇ ਆਪਾਂ ਕਿਵੇਂ ਕਿਵੇਂ ਫਰੈਸ਼ ਚੀਜ਼ਾਂ ਦੇ ਨਾਲ ਸਕਰੈਚ ਤੋਂ ਐਂ ਜਿਹੜੀਆਂ ਆਪਾਂ ਚੀਜ਼ਾਂ ਕਿਵੇਂ ਬਣਾ ਸਕਦੇ ਹਾਂ ਉਹ ਚੀਜ਼ਾਂ ਏ ਜਿਹੜੀਆਂ ਮੈਂ ਉਹ ਸਿੱਖਣੀਆਂ ਚਾਹਵਾਂਗੀ ਇਸ ਤੋਂ ਇਲਾਵਾ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਆਪਾਂ ਤੰਦੂਰ ਲਾਉਂਦੇ ਹੁੰਦੇ ਸੀਗੇ ਹਾਰੇ ਦੇ ਵਿੱਚ ਦਾਲਾਂ ਬਣਾਉਂਦੇ ਹੁੰਦੇ ਸੀਗੇ ਜਿਹੜੇ ਸਾਡੇ ਪਿੱਛੇ ਦਾਦੀ ਜੀ ਹੁਣੀ ਬਣਾਉਂਦੇ ਹੁੰਦੇ ਸੀ ਉਹ ਚੀਜ਼ਾਂ ਅੱਜ ਕੱਲ੍ਹ ਨਹੀਂ ਹੈਗੀਆਂ ਸੋ ਉਹ ਚੀਜ਼ਾਂ ਵੀ ਹੈ ਜਿਹੜੀਆਂ ਮੈਂ ਪੁਰਾਤਨ ਚੀਜ਼ਾਂ ਵੀ ਹੈ ਜਿਹੜੀਆਂ ਉਹ ਸਿੱਖਣੀਆਂ ਚਾਹੁੰਦੀ ਹਾਂ ਜਿਹਦੇ ਵਿੱਚ ਮੈਂ ਅੱਜ ਕੱਲ੍ਹ ਦਾ ਟੇਸਟ ਵਿੱਚ ਪਾ ਕੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਮੈਂ ਆਪਣੇ ਪਰਿਵਾਰ ਦੇ ਲਈ ਬਣਾ ਸਕਾਂ